ਹੈਲੋ ਹੈਲੋ ਸਤਿ ਸ਼੍ਰੀ ਅਕਾਲ ਰਜਵੰਤ ਮੈਮ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਬਸ ਮੈਮ ਹੋਰ ਕੀ ਕਰਦੇ ਪਏ ਹੋਰ ਛੁੱਟੀਆਂ ਮਨਾ ਰਹੇ ਬਸ ਹੋਰ ਪੇਪਰ ਪੇਪਰ ਚੈੱਕ ਹੋ ਗਏ ਸਾਰੇ

ਹਾਂ ਅੱਛਾ ਮੈਨੂੰ ਮੈਂ ਵੀ ਆਲਮੋਸਟ ਤਿੰਨ ਚਾਰ ਬੰਡਲ ਹੋ ਗਏ ਇੱਕ ਜਾਂ ਦੋ ਰਹਿ ਗਏ ਨੇ ਚਲੋ ਹੁਣ ਹਾਂ ਚਲੋ ਮੈਂ ਇਸ ਵਾਸਤੇ ਤੁਹਾਨੂੰ ਕਾਲ ਕੀਤੀ ਸੀ ਮੈਂ ਕਿਹਾ ਪਤਾ ਕਰਾਂ ਕਿ ਨੈਕਸਟ ਆਪਾਂ ਪੰਜਾਬੀ ਦੇ ਦੋਨੋਂ ਟੀਚਰ ਆ ਟੀਚਰ ਵੀ ਪੜ੍ਹਾਉਂਦੇ ਹਾਂ ਕਲਾਸ ਨੂੰ ਅਸੀਂ ਕਿਵੇਂ ਕਰੀਏ ਨੈਕਸਟ ਲੈਸਨ ਪਲੈਨ ਵੀ ਕਿਵੇਂ ਕਰੀਏ ਹਾਂ ਹਾਂ ਹਾਂ ਹਾਂ ਪਰ ਹਾਂ ਪ੍ਰੀ ਬੋਡਿੰਗ ਟੈਸਟ ਵਾਸਤੇ ਹਾਂ ਮੇਰੀ ਤਾਂ ਇਹੀ ਸਲਾਹ ਹੈ ਕਿ ਆਪਾਂ ਜਿਵੇਂ ਨਾਈਨ ਚੈਪਟਰ ਪਿਛਲੇ ਰਹਿ ਗਏ ਨੇ ਸੈਕਿੰਡ ਟਰਮ ਦੇ ਪਹਿਲੇ ਮਤਲਬ ਪੰਜ ਕੁ ਚੈਪਟਰ ਕਰਵਾ ਲਈਏ ਅਤੇ ਉਹਦੇ ਵਿੱਚ ਥੋੜ੍ਹਾ ਜਿਹਾ ਗੈਬ ਦੇ ਕੇ ਫਿਰ ਆਪਾਂ ਜਿਹੜਾ ਮਤਲਬ ਗਰੈਮਰ ਪੋਸ਼ਨ ਐਸਏ ਲੈਟਰ ਔਰ ਦੈਨ ਸੰਮਥਿੰਗ ਬਹੁਤੇ ਸ਼ਬਦਾਂ ਦਾ ਥਾਂ ਇੱਕ ਸ਼ਬਦ ਸਮਾਨ ਆਰਥਿਕ ਉਹ ਕਰਵਾ ਦਈਏ ਅਤੇ ਉਹਦੇ ਅਕੋਰਡਿੰਗ ਹਾਂ ਅਤੇ ਉਹਦੇ ਅਕੋਰਡਿੰਗ ਅਸੀਂ ਅੱਜ ਕਰੀਏ ਕਿ ਜਿਵੇਂ ਪਹਿਲੇ ਦੋ ਪਰਿਓਡਿਕ ਜਿਹੜੇ ਚੈਪਟਰ ਉਹ ਕਰਵਾ ਦਈਏ ਅਤੇ ਉਹ ਬੱਚਿਆਂ ਦੇ ਫਿੰਗਰਟਿਪਸ 'ਤੇ ਲਰਨ ਹੋ ਜਾਣ ਠੀਕ ਹੈ ਨਾ ਅਤੇ ਉਹਦੇ ਅਕੋਰਡਿੰਗ ਫਿਰ ਉਹਨਾਂ ਨੂੰ ਪ੍ਰਓਡਿਕ ਦੇਣਾ ਇਜੀ ਹਾਂ ਈਜ਼ੀ ਹੋ ਜਾਏਗਾ ਅਤੇ ਬਾਕੀ ਸਾਡਾ ਸਿਲੇਬਸ ਨਾਲ ਨਾਲ ਚਲਾਉਂਦੇ ਰਹਿੰਦੇ ਹਾਂ ਜਿਹੜਾ ਸੈਕਿੰਡ ਟਰਮ ਦਾ ਸਿਲੇਬਸ ਹੈ ਅਤੇ ਵਿਆਕਰਨ ਵਿੱਚ ਆਪਾਂ ਹਾਂ ਮੁਹਾਵਰੇ ਔਰ ਸਮਾਨ ਆਰਥਿਕ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਔਰ ਇਸ ਵਾਰੀ ਮੈਂ ਕਿਹਾ ਲਾਸਟ ਜਿਹੜਾ ਹੈਗਾ ਸੈਕਿੰਡ ਟਰਮ ਉਹਦੇ ਵਿੱਚ ਪਿਕਚਰ ਚਿੱਤਰ ਵਰਣਨ ਵੀ ਕਰਵਾ ਦਈਏ ਹੈ ਨਾ ਚਿੱਤਰ ਵਰਣਨ ਫਸਟ ਟਰਮ 'ਚ ਕਰਵਾਇਆ ਨਹੀਂ ਹਾਂ ਨੈਚੁਰਲੀ ਹੈ ਹੈ ਨਾ ਮੈਂ ਕਿਹਾ ਪਿਛਲੇ ਟਰਮ 'ਚ ਆਪਾਂ ਚਿੱਤਰ ਵਰਨਣ ਨਹੀਂ ਕਰਵਾਇਆ ਅਤੇ ਇਸ ਟਰਮ 'ਚ ਕਰਵਾ ਦਈਏ ਹੋਰ ਕੀ ਹਾਲ ਹੈ ਠੀਕ ਹੈ ਚਲੋ ਬਾਕੀ ਫਿਰ ਇੰਨਾ ਕੁ ਦੇਖ ਲਈਏ ਬਾਕੀ ਸਕੂਲ ਆਉਣ ਕੇ ਆਪਾਂ ਡਿਸਕਸ਼ਨ ਕਰ ਲਵਾਂਗੇ ਕਿ ਕੀ ਹੈ ਠੀਕ ਹੈ ਨਾ ਥੈਂਕ ਯੂ ਸੋ ਮਚ ਓਕੇ